ਤੁਹਾਡੇ ਸੱਭਿਆਚਾਰ ਵਿੱਚ ਔਰਤਾਂ ਵਿੱਚ ਮਾਹਵਾਰੀ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ ਕੀ ਮਾਹਵਾਰੀ ਦੌਰਾਨ ਔਰਤਾਂ ਨੂੰ ਪਾਲਣ ਕਰਨ ਲਈ ਹੋਰ ਨਿਯਮ ਹਨ ਕੀ ਸਵੱਛਤਾ ਅਤੇ ਸਿਹਤ ਬਾਰੇ ਕਾਫ਼ੀ ਜਾਗਰੂਕ ਹੈ ਹਾਂਜੀ ਸਰ ਜਿਵੇਂ ਕਿ ਔਰਤਾਂ ਨੂੰ ਮਹੀਨੇ ਬਾਅਦ ਮਾਹਵਾਰੀ ਆਉਂਦੀ ਹੈ ਉਹ ਸਾਡੇ ਡਿਸਪੈਂਸਰੀ ਜਾਂ ਸਰਕਾਰੀ ਹੋਸਪੀਟਲਾਂ ਵਿੱਚ ਉਹਨਾਂ ਨੂੰ ਪ੍ਰੋ ਜਾਂ ਵਿਸਪਰ ਵਗੈਰਾ ਮਿਲ ਜਾਂਦੇ ਆ ਸਰ ਜੀ ਉਹ ਉਹ ਲਾ ਲੈਂਦੇ ਹੈ ਜਿਵੇਂ ਕਿ ਘਰ ਦੇ ਵਿੱਚ ਹੀ ਔਰਤਾਂ ਕੱਪੜਾ ਵਗੈਰਾ ਜਾਂ ਹੋਰ ਯੂਜ਼ ਕਰ ਲੈਂਦੇ ਹੈ ਇਹਨਾਂ ਨੂੰ ਸਰ ਇਸ ਤੋਂ ਇਸ ਤਰੀਕੇ ਨਾਲ ਇਹ ਬਚਾਇਆ ਜਾ ਸਕਦਾ ਹੈ ਤਾਂ ਕਿ ਹੋਰ ਸਰ ਹੋਰ ਤਾਂ ਕੋਈ ਹੱਲ ਹੈ ਨਹੀਂ ਔਰਤਾਂ ਪ੍ਰੋ ਵਿਸਪਰ ਜਾਂ ਸੇਅਫ੍ਰੀ ਵਗੈਰਾ ਯੂਜ਼ ਕਰਦੀਆਂ ਇਸ ਸਮੇਂ ਅਤੇ ਸਰਕਾਰੀ ਹਸਪਤਾਲਾਂ ਵਿੱਚ ਜੋ ਵੀ ਸਹੂਲਤਾਂ ਮਿਲਦੀਆਂ ਸਰ ਡਿਸਪੈਂਸਰੀ ਵਿੱਚ ਉਹ ਸਰ ਲੈ ਲੈਂਦੇ ਆ ਉਹ ਉਹਨਾਂ ਕੋਲ ਜਾਂਦੇ ਆ ਅਤੇ ਉਹ ਆਪਣੇ ਸੁਝਾਅ ਮੁਤਾਬਕ ਉਹਨਾਂ ਨੂੰ ਜੋ ਵੀ ਉੱਥੇ ਲੋੜੀਂਦੀਆਂ ਚੀਜ਼ਾਂ ਉਪਲਬਧ ਹਨ ਉਹ ਸਰ ਦੇ ਦਿੰਦੇ ਆ ਜਿਸ ਦੇ ਨਾਲ ਔਰਤਾਂ ਇਸ ਸਮੇਂ ਆਪਣਾ ਜੋ ਮਹੀਨੇ ਵਿੱਚ ਪੀੜਤਾ ਸਮ ਬਿੜਤਾ ਦੇ ਸਮੇਂ ਵਿੱਚ ਵਿਸਪਰ ਪ੍ਰੋ ਜੋ ਵੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਉਹ ਡਿਸਪੈਂਸਰੀ ਜਾਂ ਹਸਪਤਾਲ ਸਰਕਾਰੀ ਹਸਪਤਾਲਾਂ ਵਿੱਚੋਂ ਸਰ ਉਪਲਬਧ ਹਨ ਅਤੇ ਉਹ ਸਰ ਘਰ ਵੀ ਪਹੁੰਚਾ ਦਿੰਦੀਆਂ ਆਂਗਣਵਾੜੀ ਵਾਲੀਆਂ ਮੈਡਮਾਂ ਜਾਂ ਫਿਰ ਇਹਨਾਂ ਨੂੰ ਸਰਕਾਰੀ ਹਸਪਤਾਲਾਂ ਵਿੱਚੋਂ ਹੀ ਲੈ ਕੇ ਆਉਣਾ ਪੈਂਦਾ ਹੈ